ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਮੋਹਾਲੀ ਤੋਂ ਮੋਹਾਲੀ ਤੋਂ ਬੋਲਦਾ ਹਾਂਜੀ ਅਤੇ ਮੈਂ ਟ੍ਰੇਨ ਬਾਰੇ ਪੁੱਛਣਾ ਸੀਗਾ ਜੀ ਮੈਂ ਦਿੱਲੀ ਜਾਣਾ ਦਿੱਲੀ ਦਿੱਲੀ ਜਾਣਾ ਹੈ ਅਤੇ ਉਹਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਸ਼ਹਿਰ ਆਉਂਦੇ ਜੀ

ਅੱਛਾ ਜੀ ਸਿੱਧਾ

ਏ ਸੀ ਵਾਲੀ ਜੀ ਸਿੰਗਲ

ਹਾਂਜੀ ਅਤੇ ਉਹਦੇ 'ਚ ਫੈ ਫੈਸੇਲਿਟੀ ਕਿਆ ਹੈ ਜੀ ਕਿਆ ਮਤਲਬ ਕਿ ਖਾਣਾ ਪੀਣਾ ਬੈੱਡ ਵਗੈਰਾ ਜੀ

ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੈਂ ਕਰਦਾ ਜੀ ਤੁਹਾਨੂੰ ਫੋਨ ਓਕੇ